ਖੇਡਾਂ ਦਾ ਤਾਂ ਸਾਡੇ ਜੀਵਨ ਉੱਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਅਤੇ ਚੰਗਾ ਪ੍ਰਭਾਵ ਪੈਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਇਸ ਦਾ ਪ੍ਰਭਾਵ ਆਪਣੇ ਜੀਵਨ 'ਤੇ ਪੈਂਦਾ ਹੈ ਕਿ ਇਸ ਦੇ ਨਾਲ ਖੇਡਾਂ ਨਾਲ਼ ਜੁੜਨ ਤੋਂ ਆਪਣਾ ਸਰੀਰ ਫਿੱਟ ਰਹਿੰਦਾ ਹੈ ਆਪਣੀ ਸਿਹਤ ਚੰਗੀ ਰਹਿੰਦੀ ਹੈ ਅਤੇ ਸਾਰਾ ਦਿਨ ਤਰੋ ਤਾਜ਼ਾ ਮਹਿਸੂਸ ਕਰਦੇ ਹਨ ਅਤੇ ਖੇਡਣ ਜਦੋਂ ਆਪਾਂ ਗਰਾਊਂਡ ਵਿੱਚ ਖੇਡਣ ਲਈ ਉਤਰਦੇ ਹਨ ਇਸ ਦੇ ਨਾਲ਼ ਆਪਣੀ ਭਾਈਵਾਲਤਾ ਵੱਧਦੀ ਹੈ ਅਤੇ ਇੱਕ ਚੰਗੀ ਲੀਡਰਸ਼ਿਪ ਪੈਦਾ ਹੁੰਦੀ ਹੈ ਖੇਡਾਂ ਦੇ ਵਿੱਚ ਖੇਡਣ ਦੇ ਨਾਲ਼ ਖਿਡਾਰੀ ਦਾ ਸਰੀਰ ਬਹੁਤ ਉਹਨੂੰ ਸਰੀਰ ਪੱਖੋਂ ਬਹੁਤ ਹੀ ਜ਼ਿਆਦਾ ਮਦਦ ਮਿਲਦੀ ਹੈ ਉਹ ਬਹੁਤ ਹੀ ਫਿੱਟ ਰਹਿੰਦਾ ਹੈ ਅਤੇ ਸਾਰਾ ਦਿਨ ਐਕਟਿਵ ਰਹਿੰਦਾ ਹੈ ਅਤੇ ਇਸ ਦੇ ਨਾਲ਼ ਨਾਲ਼ ਉਹ ਆਪਣੇ ਦਿਲ ਵਿੱਚ ਖੇਡਾਂ ਨੂੰ ਲੈ ਕੇ ਬਹੁਤ ਹੀ ਮਾਣ ਆਦਰ ਸਤਿਕਾਰ ਅਤੇ ਪਿਆਰ ਰੱਖਦਾ ਹੈ ਜਿਸ ਦੇ ਨਾਲ਼ ਉਸਦਾ ਸਾਰਾ ਜੀਵਨ ਅਤੇ ਸਾਰਾ ਦਿਨ ਬਹੁਤ ਹੀ ਖੁਸ਼ੀ ਨਾਲ਼ ਬਤੀਤ ਹੁੰਦਾ ਹੈ